ਪੇਂਡੂ ਸਮਾਜ ਦੀ ਖੇਡਾਂ ਬਾਰੇ ਬਹੁਤ ਵਧੀਆ ਰਾਏ ਹੈ ਪੇਂਡੂ ਸਮਾਜ ਖੇਡਾਂ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦੇ ਸਨ ਕਿਉਂਕਿ ਖੇਡਾਂ ਨਾਲ਼ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਖੇਡਾਂ ਨਾਲ਼ ਸਾ ਅਸੀਂ ਸਾਡੇ ਸਰੀਰ ਨੂੰ ਬਹੁਤ ਤੰਦਰੁਸਤੀ ਮਿਲਦੀ ਹੈ ਸਾਨੂੰ ਖੇਡਾਂ ਖੇਡ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਪਿੰਡਾਂ ਦੇ ਲੋਕ ਹੱਥੀਂ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਹਨ ਪਿੰਡਾਂ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਹੁਣ ਆਪਾਂ ਕਿਸੇ ਵੀ ਜਗ੍ਹਾ 'ਤੇ ਦੇਖ ਲਈਏ ਜਦੋਂ ਵੀ ਕੋਈ ਮੈਚ ਹੁੰਦਾ ਹੈ ਤਾਂ ਉੱਥੇ ਪਿੰਡਾਂ ਦੇ ਬੱਚੇ ਹੀ ਜ਼ਿਆਦਾਤਰ ਭਾਗ ਲੈਂਦੇ ਹਨ ਪਿੰਡਾਂ ਦੇ ਲੋਕ ਖੇਡਾਂ ਵਗੈਰਾ ਵਿੱਚ ਬਹੁਤ ਜ਼ਿਆਦਾ ਅੱਗੇ ਹੁੰਦੇ ਹਨ ਪਿੰਡਾਂ ਵਿੱਚ ਜ਼ਿਆਦਾਤਰ ਘੋਲ ਵਗੈਰਾ ਕਰਵਾਏ ਜਾਂਦੇ ਹਨ ਪਿੰਡ ਦੇ ਸਰਪੰਚ ਫਿਰ ਖਿ ਪਹਿਲਵਾਨਾਂ ਨੂੰ ਘਿਓ ਦੇ ਡੱਬੇ ਲਿਆ ਕੇ ਦਿੰਦੇ ਸਨ ਪਿੰਡਾਂ ਵਾਲੇ ਲੋਕ ਪਿੰਡਾਂ ਦੇ ਲੋਕਾਂ ਲਈ ਖੇਡਾਂ ਦਾ ਬਹੁਤ ਮਹੱਤਵ ਹੈ ਪੇਂਡੂ ਸਮਾ ਪੇਂਡੂ ਸਮਾਜ ਖੇਡਾਂ ਲਈ ਖੇਡਾਂ ਦਾ ਮੇਲਾ ਵੀ ਮਨਾਉਂਦੇ ਹਨ ਜਿਸ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਪਿੰਡਾਂ ਪਿੰਡ ਦੇ ਲੋਕ ਖੇਡਾਂ ਪ੍ਰਤੀ ਬਹੁਤ ਸਾਰੀ ਹਮਦਰਦੀ ਰੱਖਦੇ ਹਨ